ਪੰਜਾਬ ਵਿੱਚ ਜੇਕਰ ਮੈਂ ਗੱਲ ਕਰਾਂ ਮੋਹਾਲੀ ਜ਼ਿਲ੍ਹੇ ਦੀ ਤਾਂ ਇੱਥੇ ਬਹੁਤ ਸਾਰੇ ਸਿਹਤ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਹਨ ਬਹੁਤ ਸਾਰੇ ਮੁਹੱਲਾ ਕਲੀਨਿਕ ਹਰ ਇੱਕ ਸੈਕਟਰ ਫੇਸਾਂ ਦੇ ਵਿੱਚ ਖੁੱਲ੍ਹੇ ਹੋਏ ਹਨ ਅਤੇ ਇਸ ਤੋਂ ਇਲਾਵਾ ਇੱਥੇ ਹਰ ਇੱਕ ਡਿਸਪੈਂਸਰੀਆਂ ਵਿੱਚ ਵੀ ਵੀ ਵਧੀਆ ਡਾਕਟਰ ਨਿਯੁਕਤ ਕੀਤੇ ਗਏ ਹਨ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੀ ਤਕਲੀਫਾਂ ਦਾ ਹੱਲ ਹੋ ਸਕੇ ਇਸ ਤੋਂ ਇਲਾਵਾ ਅ ਗੁਰਦੁਆਰਿਆਂ ਵਿੱਚ ਵੀ ਕਈ ਲੋਕਾਂ ਨੇ ਸਰਕਾਰ ਅਤੇ ਲੋਕਾਂ ਦੇ ਮਿਲੀ ਜੁਲੀ ਹੀ ਉ ਉਪਰਾਲੇ ਕਾਰਨ ਇੱਕ ਇਹੋ ਜਿਹਾ ਕਮਰਾ ਵੀ ਬਣਾਇਆ ਗਿਆ ਹੈ ਜਿੱਥੇ ਲੋੜ ਪੈਣ 'ਤੇ ਲੋਕਾਂ ਨੂੰ ਫਸਟ ਏਡ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਫਰੀ ਸੇਵਾ ਐਬੂਲੈਂਸ ਰਾਹੀਂ ਉਹਨਾਂ ਨੂੰ ਵੱਡੇ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਕੈਂਪ ਵੀ ਲੱਗਦੇ ਹਨ ਜਿਨ੍ਹਾਂ ਕਾਰਨ ਲੋਕਾਂ ਕਾਂ ਦੇ ਸਰੀਰਕ ਟੈਸਟ ਹੁੰਦੇ ਹਨ ਜਿਵੇਂ ਬਲੱਡ ਕੈਂਪ ਕੈਂਸਰ ਕੈਂਪ ਵੱਖ ਵੱਖ ਤਰ੍ਹਾਂ ਦੇ ਇਹ ਕੈਂਪ ਲੱਗਦੇ ਰਹਿੰਦੇ ਹਨ ਰੋਜ਼ਾਨਾ ਤਾਂ ਕਿ ਲੋਕ ਸਵੱਸਥ ਰਹਿ ਸਕਣ ਅਤੇ ਵਧੀਆ ਜੀਵਨ ਬਤੀਤ ਕਰ ਸਕਣ